ਹੈਲੋ ਹੈਲੋ ਤੁਸੀਂ ਭਾਅ ਜੀ ਸਤਿ ਸ਼੍ਰੀ ਅਕਾਲ ਤੁਸੀਂ ਨਵਜੋਤ ਡੀਲਰਜ਼ ਬੋਲ ਰਹੇ ਓ ਮੈਂ ਆਪਣੇ ਨਾ ਫ੍ਰੈਡ ਤੋਂ ਪੁੱਛਿਆ ਸੀ ਮੈਂ ਇੱਕ ਗੱਡੀ ਲੈਣੀ ਸੀ ਤਾਂ ਉਹਨੇ ਮੈਨੂੰ ਸਜੈਸਟ ਕੀਤਾ ਕੀ ਨਵਜੋਤ ਡੀਲਰ ਨੂੰ ਪੁੱਛੋ ਵਧੀਆ ਗੱਡੀਆਂ ਉਹ ਕਰਦਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਓ ਗੱਡੀਆਂ ਬਾਰੇ ਤੁਹਾਡੇ ਕੋਲ ਕਿਹੜੀ ਗੱਡੀ ਅਵੇਲੇਵਲ ਹੈ ਮੈਨੂੰ ਵੱਡੀ ਗੱਡੀ ਗੱਡੀ ਚਾਹੀਦੀ ਹੈ ਮਤਲਬ ਮੈਨੂੰ ਮਤਲਬ ਅੱਠ ਨੌ ਲੱਖ ਤੋਂ ਮਤਲਬ ਉੱਪਰ ਲੈ ਕੇ ਬਾਰਾਂ ਕੁ ਲੱਖ ਤੱਕ ਚਾਹੀਦੀ ਹੈ ਹਾਂਜੀ ਤੁਹਾਡੇ ਕੋਲ ਕਿਹੜੇ ਕਿਹੜੇ ਉਹ ਤਾਂ ਮਤਲਬ ਆਪਾਂ ਮਿਲ ਕੇ ਦੇਖਾਂਗੇ ਇਸ ਟਾਈਮ ਤੁਸੀਂ ਮੈਨੂੰ ਉੱਦਾਂ ਡੀਟੇਲਜ਼ ਪ੍ਰੋਵਾਇਡ ਕਰ ਸਕਦੇ ਓ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਅਵੇਲੇਵਲ ਹੈ ਹਾਂ ਅਤੇ ਮੈਨੂੰ ਨਾ ਸਰ ਨੰਬਰ ਰਜਿਸਟਰਡ ਚਾਹੀਦਾ ਉਹ ਦਿੱਲੀ ਦਾ ਚਾਹੀਦਾ ਹੈ ਅੱਛਾ ਉਹ ਕਿੰਨਾਂ ਕੁ ਮਤਲਬ ਕਿੰਨੀ ਚੱਲੀ ਹੋਈ ਹੈ ਕਿਆ ਉਹਦੀ ਐਵਰੇਜ ਵਗੈਰਾ ਸਾਰਾ ਕੁੱਛ ਦੱਸ ਤੁਸੀਂ ਡੀਟੇਲ ਪ੍ਰੋਵਾਇਡ ਕਰ ਸਕਦੇ ਓ ਇੱਥੇ ਜਾਂ ਫਿਰ ਮੈਨੂੰ ਉੱਥੇ ਆਉਣਾ ਪਊਗਾ ਹਾਂਜੀ ਹਾਂਜੀ

ਠੀਕ ਹੈ ਠੀਕ ਹੈ ਠੀਕ ਹੈ ਮਤਲਬ ਫ੍ਰੈਸ਼ ਮਾਡਲ ਹੈ ਜ਼ਿਆਦਾ ਨਹੀਂ ਚੱਲੀ ਉਹਦੀ ਕੀ ਪਰਾਇਜ਼ ਰੇਂਜ ਦੇ ਵਿੱਚ ਆ ਰਹੀ ਹੈ ਉਹ ਗੱਡੀ

ਠੀਕ ਹੈ ਓਕੇ ਠੀਕ ਹੈ ਅਤੇ ਫਿਰ ਮੈਂ ਬਾਕੀ ਡੀਟੇਲ ਤੁਹਾਨੂੰ ਆ ਕੇ ਤੁਹਾਡੇ ਨਾਲ਼ ਪਰਸਨਲੀ ਪਰਸਨਲੀ ਗੱਲ ਕਰ ਲਵਾਂਗੀ ਹਾਂ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਤੁਸੀਂ ਮੈਨੂੰ ਆਪਣੇ ਔਫ਼ਿਸ ਦਾ ਐਡਰੈਸ ਪ੍ਰੋਵਾਇਡ ਕਰ ਦਿਓ ਸੋ ਦੈਟ ਕੀ ਮੈਂ ਕਨਵੀਨੀਅਸ ਨਾਲ਼ ਤੁਹਾਡੇ ਕੋਲ ਆ ਜਾਵਾ ਤੁਸੀਂ ਕੱਲ੍ਹ ਮਤਲਬ ਮੈਨੂੰ ਸਵੇਰੇ ਨੂੰ ਦਸ ਵਜੇ ਮਿਲ ਜਾਓਗੇ ਠੀਕ ਹੈ ਓਕੇ ਥੈਂਕ ਯੂ